ਸਾਡੇ ਘਰ ਵਿੱਚ ਸਰਦੀਆਂ ਸ਼ੁਰੂ ਹੋਣ ਸਾਰ ਹੀ ਪੰਜੀਰੀ ਬਣਾਏ ਬਣਾ ਲਈ ਜਾਂਦੀ ਹੈ ਕਿਉਂਕਿ ਜਿਹੜੀ ਇਹ ਪੰਜੀਰੀ ਹੈ ਸਾਡੇ ਪੀੜ੍ਹੀ ਦੁਆ ਪੀੜ੍ਹੀ ਦਰ ਪੀੜ੍ਹੀ ਚੱਲਦੀ ਆ ਰਹੀ ਹੈ ਇਹ ਪਿਛਲੇ ਟੈਮ 'ਚ ਪਹਿਲਾਂ ਬੁੱਢੇ ਦਾਦੇ ਦਾਦੀਆਂ ਬਹੁਤ ਖਾਂਦੇ ਹੁੰਦੇ ਸੀ ਫਿਰ ਓਸ ਤੋਂ ਬਾਅਦ ਪਹਿਲਾਂ ਸਾਡੇ ਪੜ੍ਹਦਾਦੀ ਫਿਰ ਸਾਡੇ ਦਾਦੀ ਅਤੇ ਫਿਰ ਅੱਗੇ ਹੁਣ ਅਸੀਂ ਬਣਾਨੇ ਹਾਂ ਇਹ ਜਿਹੜੀ ਪੰਜੀਰੀ ਹੈ ਇਹ ਸਾਨੂੰ ਬਹੁਤ ਤਾਕਤ ਦਿੰਦੀ ਹੈ ਅਤੇ ਸਰਦੀਆਂ 'ਚ ਹੱਡ ਗੋਡੇ ਘੱਟ ਦੁਖਦੇ ਹੈ ਤਾਂ ਇਸ ਕਰਕੇ ਬਜ਼ੁਰਗ ਖਾਂਦੇ ਨੇ ਸਾਡੇ ਘਰ ਵਿੱਚ ਤਾਂ ਇਹ ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਣਾ ਲਿੱਤੀ ਜਾਂਦੀ ਏ ਅਤੇ ਫਿਰ ਇਹਨੂੰ ਡੱਬੇ 'ਚ ਪੈਕ ਕਰਕੇ ਰੱਖ ਲਿਆ ਜਾਂਦਾ ਹੈ ਨਾ ਹੀ ਜਲਦੀ ਜੀ ਖਰਾਬ ਹੁੰਦੀ ਹੈ ਨਾ ਇਹਨੂੰ ਉੱਲੀ ਲੱਗਦੀ ਹੈ ਇੰਨੀ ਛੇਤੀ ਥੋੜ੍ਹੇ ਟਾਇਮ ਬਾਅਦ ਸ਼ ਸ਼ਾਇਦ ਲੱਗ ਵੀ ਜਾਵੇ ਪਰ ਸਾਡੇ ਤਾਂ ਕਦੇ ਲੱਗੀ ਨਹੀਂ ਅਤੇ ਇਹ 'ਚ ਆਟਾ ਪਾਇਆ ਜਾਂਦਾ ਹੈ ਦੇਸੀ ਘੀ ਪਾਇਆ ਜਾਂਦਾ ਹੈ ਮਖਾਣੇ ਕਿਸ਼ਮਿਸ਼ ਦਾਖ਼ਾ ਕਾਜੂ ਸਾਰਾ ਕੁਛ ਪਾ ਕੇ ਓਹਦਾ ਮਿਕਸ਼ਚਰ ਬਣਾ ਕੇ ਮਤਲਬ ਇਹ ਪੰਜੀਰੀ 'ਚ ਪਾਇਐ ਜਾਂਦੈ ਦੇਸੀ ਘਿਓ ਦੀ ਪੰਜੀਰੀ ਬਣਦੀ ਹੈ ਅਤੇ ਪਹਿਲਾਂ ਤਾਂ ਸਾਰੇ ਮਤਲਬ ਜਿਹੜੇ ਜਿੰਨੇ ਵੀ ਫੈਮਲੀ ਦੇ ਬੰਦੇ ਹੁੰਦੇ ਸੀ ਸਭ ਖਾ ਲੈਂਦੇ ਸੀ ਪਰ ਅੱਜ ਕੱਲ੍ਹ ਬੱਚੇ ਇੱਦਾਂ ਦੇ ਨੇ ਜਿਹੜੇ ਦੇਸੀ ਘੀ ਨਹੀਂ ਖਾਂਦੇ ਜਿਵੇਂ ਮੇਰੇ ਭੈਣ ਭਰਾ ਲਾ ਲਉ ਅਸੀਂ ਦੇਸੀ ਘੀ ਨਹੀਂ ਖਾਂਦੇ ਪਤਾ ਨਹੀਂ ਕਿਉਂ ਪਰ ਸਾਡੇ ਮੰਮੀ ਡੈਡੀ ਬਹੁਤ ਖਾਂਦੇ ਨੇ ਅਤੇ ਸਾਡੇ ਘਰ ਤਾਂ ਹਰੇਕ ਸਾਲ ਪੰਜੀਰੀ ਬਣਦੀ ਹੀ ਬਣਦੀ ਹੈ ਅਤੇ ਇਹਨੂੰ ਤੁਸੀਂ ਸਾਡਾ ਪਰਿਵਾਰਿਕ ਪਕਵਾਨ ਵੀ ਕਹਿ ਸਕਦੇ ਹੋ